ਹੈਲੋ ਹਾਂਜੀ ਸਰ ਸਿਮਰਨਜੀਤ ਕੌਰ ਗੱਲ ਕਰਦੇ ਆ ਤੁਸੀਂ ਕੌਣ ਕਰਦੇ ਸਰ ਠੀਕ ਹੈ ਸਰ ਸਾਡੇ ਨੇਬਰ ਹੀ ਆ ਹਾਂਜੀ ਹਾਂਜੀ

ਠੀਕ ਹੈ ਸਰ

ਠੀਕ ਹੈ ਸਰ ਤੇ ਸਰ ਤੁਸੀਂ ਜੇ ਬਿਲਕੁਲ ਸਸਤੀ ਤੇ ਫਰੈਸ਼ ਸਬਜੀ ਜੇ ਤੁਸੀਂ ਲੈਣੀ ਲੈਣੀ ਹੈ ਨਾ ਤੇ ਤੁਸੀਂ ਇਥੇ ਮੰਡੀ ਦੇ ਵਿੱਚ ਜਾਓ ਜਿਹੜੀ ਵੱਡੀ ਮੰਡੀ ਹੈਗੀ ਆਪਣੀ ਸੁਭਾਸ਼ ਚੰਦ ਸ਼ੋਪ ਦੇ ਕੋਲ ਜਿਹੜੀ ਹੈਗੀ ਆ ਨਾ ਸ਼ੁਭਾਸ਼ ਚੰਦਰ ਚੋਕ ਹੈਗਾ ਸਰ ਉੱਥੇ ਇੱਕ ਬਹੁਤ ਸੁਭਾਸ਼ ਚੰਦਰ ਚੋਕ ਹੈਗਾ ਇਥੇ ਹਾਂਜੀ ਸਰ ਹਾਂਜੀ ਸਰ ਤੇ ਉਥੇ ਤੁਸੀਂ ਜਾਓ ਸਰ ਉਥੇ ਤੁਹਾਨੂੰ ਬਹੁਤ ਸਪੈਸ਼ਲ ਸਬਜ਼ੀ ਮਿਲਣਗੀ ਤੇ ਨਾਲੇ ਸਸਤੀਆਂ ਵੀ ਹੈਗੀਆ ਬਹੁਤ ਸਸਤੇ ਸਰ ਮਹਿੰਗੀ ਤੇ ਚਲੋ ਹੁੰਦੀ ਆ ਪਰ ਤੁਸੀਂ ਤੁਸੀਂ ਕਿਹੜਾ ਇਕ ਕਿਲੋ ਜਾਂ ਦੋ ਕਿਲੋ ਲੈਣਾ ਤੁਸੀਂ ਤੇ ਇਕੱਠੇ ਹੀ ਚੱਕਣਾ ਸਮਾਨ ਤੇ ਉਹ ਤੁਹਾਨੂੰ ਬਿਲਕੁਲ ਹਾਂ ਤੇ ਤੁਸੀਂ ਉੱਥੇ ਲੈ ਲਓ ਉੱਥੇ ਉਧਰ ਦੇ ਜਿਹੜੇ ਹੈਗੇ ਆ ਸਬਜੀ ਵਗੈਰਾ ਬਹੁਤ ਸਾਫ ਸੁਥਰੀ ਹੁੰਦੀ ਹ ਤਾਂ ਨਾਲੇ ਫਰੈਸ਼ ਬਹੁਤ ਹੁੰਦੀ ਆ ਜੇ ਸਰ ਤੁਸੀਂ ਕਾਰ ਨਾਲ ਲੈਕੇ ਜਾਇਓ ਕਿਉਂਕਿ ਕਾਰ ਲੈ ਕੇ ਜਾਓਗੇ ਉਥੇ ਗਲੀਆਂ ਹੈਗੀਆਂ ਨਿੱਕੀਆਂ ਨਿੱਕੀਆਂ ਤੇ ਉੱਥੇ ਆਪਣੀ ਕਾਰ ਜਾਊਗੀ ਫਸ ਤੇ ਤੁਸੀਂ ਬੈਟਰ ਹੈਗਾ ਕੀ ਜੇ ਤਾਂ ਤੁਸੀਂ ਤੁਹਾਡੇ ਕੋਲ ਮੋਟਰਸਾਈਕਲ ਹੈਗਾ ਤਾਂ ਉਹ ਬੈਸਟ ਹੈਗਾ ਤੁਸੀਂ ਉਹ ਮੋਟਰਸਾਈਕਲ ਲੈ ਲਓ ਤੇ ਮੋਟਰਸਾਈਕਲ ਲੈ ਕੇ ਤੇ ਸਾਈਡ ਤੇ ਖਲਾਰ ਲਿਓ ਤੇ ਓਥੋਂ ਸਬਜੀ ਲੈ ਕੇ ਤੇ ਜੇ ਥਾਡੇ ਕੋਲ ਸਬਜੀ ਜਿਆਦਾ ਤੁਸੀਂ ਆਟੋ ਕਰ ਲਿਓ ਆਟੋ ਕਰਕੇ ਘਰ ਲੈ ਆਇਓ ਹਾਂ ਨਹੀਂ ਸਰ ਤੁਹਾਡਾ ਘਰ ਮੈਂ ਮੈਨੂੰ ਹੁਣ ਜਿਸ ਤਰਾਂ ਹੁਣ ਮੈਂ ਜਾਂਦੀ ਸਬਜੀ ਲੈਣ ਵਾਸਤੇ ਮੈਂ ਤਾਂ ਸਿਰਫ ਸੋ ਕ ਰੁਪਇਆ ਦਿੰਦੀ ਹ ਤਾਂ ਉਦਾਂ ਆਟੋ ਵਾਲੇ ਮੰਗਦੇ ਬਹੁਤ ਆ ਦੋ ਸੋ ਕਹਿਣਗੇ ਤਿੰਨ ਸੋ ਕਹਿਣਗੇ ਸਬਜੀ ਮੰਡੀ ਸਰ ਇਥੇ ਆਪਾਂ ਉਹ ਜਿਆਦਾ ਨਹੀਂ ਪੈਣਾ ਇੱਕ ਦੋ ਤਿੰਨ ਕਿਲੋਮੀਟਰ ਹੀ ਆ ਬਸ ਹਾਂ ਸਰ ਵੇਖੋ ਜੇ ਤਾਂ ਤੁਸੀਂ ਸਵੇਰੇ ਤੜਕੇ ਜਾਓਗੇ ਛੇ ਕ ਵਜੇ ਤੇ ਫਿਰ ਆਪਾਂ ਨੂੰ ਸਬਜੀ ਵਗੈਰਾ ਬਹੁਤ ਵਧੀਆ ਤੇ ਫਰੈਸ਼ ਮਿਲ ਜੂਗੀ ਜੇ ਤੁਸੀਂ ਬਾਅਦ ਚ ਜਾਓਗੇ ਤੇ ਫਿਰ ਉਹ ਰੇਟ ਤੇ ਤੁਹਾਨੂੰ ਸੇਮ ਹੀ ਲੱਗੂਗਾ ਪਰ ਇਹ ਹ ਕਿ ਬਚੀ ਖੁਚੀ ਸਬਜੀ ਰਹਿ ਜਾਣੀ ਆ

ਕੋਈ ਗੱਲ ਨਹੀਂ ਸਰ ਅਸੀਂ ਗੁਆਂਡੀ ਆ ਤੁਹਾਡੇ ਹਾਂਜੀ ਅਸੀਂ ਗੁਆਡੀ ਆ ਸਾਡਾ ਫਰਜ਼ ਹੈ ਕਿ ਜੇ ਤੁਸੀਂ ਨਏਂ ਆਏ ਹੋ ਤਾਂ ਸਾਡਾ ਫਰਜ਼ ਹੈ ਕਿ ਤੁਹਾਨੂੰ ਚੰਗੇ ਰਸਤੇ ਪਾਣਾ ਓਕੇ ਸਰ ਓਕੇ ਸਰ ਥੈਂਕਯੂ ਧੰਨਵਾਦ